ਮੈਂ ਤੇਲੰਗਾਨਾ ਦੀ ਸਿਟੀ ਹੈਦਰਾਬਾਦ ਅਤੇ ਸਿਕੰਦਰਾਵਾਦ ਦੀ ਯਾਤਰਾ ਕੀਤੀ ਉਹ ਮੈਨੂੰ ਬਹੁਤ ਚੰਗੀ ਲੱਗੀ ਹੈਦਰਾਬਾਦ ਵਿੱਚ ਚਾਰ ਮੀਨਾਰ ਬੜਾ ਵਧੀਆ ਹਸਤ ਕਲਾ ਦਾ ਨਮੂਨਾ ਹੈ ਜਿਸ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਅਤੇ ਇਸ ਤੋਂ ਇਲਾਵਾ ਗੋਲ ਕੰਡਾ ਕਿਲ੍ਹਾ ਗੋਲ ਕੰਡਾ ਦੇਖਿਆ ਜਿਹੜਾ ਕਿ ਪੁਰਾਣੀ ਪੁਰਾਣੀ ਸੱਭਿਅਤਾ ਨੂੰ ਦੀ ਯਾਦ ਦਿਵਾਉਂਦਾ ਹੈ ਅਤੇ ਉੱਥੇ ਬੜੇ ਬੜੇ ਪੁਰਾਣੇ ਜਗ੍ਹਾ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਇਸ ਤੋਂ ਇਲਾਵਾ ਸਿਕੰਦਰਾਵਾਦ ਵਿੱਚ ਟਰੇਨ ਰੈਸਟੋਰੈਂਟ ਦੇਖਿਆ ਜਿਹੜਾ ਕਿ ਬਹੁਤ ਵਧੀਆ ਲੱਗਾ ਉੱਥੇ ਟਰੇ ਟਰੇਨ ਟਰੇਨ ਦੇ ਦੋ ਡੱਬੇ ਲੱਗੇ ਹੁੰਦੇ ਹਨ ਅਤੇ ਉਹ ਹਰ ਇੱਕ ਹਰ ਇੱਕ ਟੇਬਲ 'ਤੇ ਆ ਕੇ ਉਹਨਾਂ 'ਚ ਸਮਾਨ ਰੱਖਿਆ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ ਹੈ ਉਹ ਹਰ ਟੇਬਲ 'ਤੇ ਆ ਕੇ ਲਾ ਕੇ ਚਲੇ ਜਾਂਦੇ ਹਨ ਅਤੇ ਅਗਲੇ ਗ੍ਰਾਹਕ ਦਾ ਅਗਲੇ ਗ੍ਰਾਹਕ ਦਾ ਔਡਰ ਲੈਂਦੇ ਹਨ ਇਹ ਮੈਨੂੰ ਬੜੇ ਚੰਗੇ ਲੱਗੇ ਦੋ ਸ਼ ਸ਼ਹਿਰ ਵੀ ਬੜੇ ਸਾਫ਼ ਸੁਥਰੇ ਹਨ ਅਤੇ ਇੱਥੇ ਸੜਕਾਂ ਅਤੇ ਬਿਲਡਿੰਗਾਂ ਦੇਖਣ ਯੋਗ ਹਨ ਜੋ ਕਿ ਬਹੁਤ ਵਧੀਆ ਹਨ